ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹੇ ਵਿੱਚ ਸਿਹਤ ਪ੍ਰਾਣ ਪ੍ਰਣਾਲੀ ਤਾਂ ਬਹੁਤ ਵਧੀਆ ਹਨ ਪਰ ਕਈ ਕਈ ਚੀਜ਼ਾਂ ਵਿੱਚ ਬਹੁਤ ਕਮੀਆਂ ਹਨ ਜਿਹਨਾਂ ਵਿੱਚ ਡਾਕਟਰ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ ਕਈ ਵਾਰ ਦਵਾਈਆਂ ਵਿੱਚ ਵੀ ਥੋੜ੍ਹੀ ਜਿਹੀ ਕਮੀ ਹੁੰਦੀ ਹੈ ਕਈ ਕ ਸਰਕਾਰੀ ਹੋਸਪੀਟਲ ਹੈ ਉਹਨਾ ਵਿੱਚ ਮ ਮਸ਼ੀਨਾਂ ਸਟਾਫ ਅਤੇ ਨਰਸਾਂ ਨੁਰਸਾਂ ਬਹੁਤ ਕਮੀ ਹੁੰਦੀ ਹੈ ਅਤੇ ਦੂਰ ਜਾਣੇ ਵਿੱਚ ਐਂਬੁਲੈਂਸ ਲਈ ਜਿੱਦਾਂ ਮਤਲਬ ਪਿੰਡ ਹੁੰਦਾ ਜੀ ਉ ਪ੍ਰਣਾਲੀ ਫ਼ੋਨ ਕਰਨੇ ਲਈ ਬਹੁਤ ਔਖਾ ਹੁੰਦਾ ਹੈ ਬਹੁਤ ਪਿੰਡਾਂ ਵਿੱਚ ਬਹੁਤ ਜਾਣਾ ਬੜਾ ਔਖਾ ਹੈ ਭਾਈ ਭ ਭਾਈਚਾਰੇ ਵਿੱਚ ਬਹੁਤ ਸਥਾਨਿਕ ਜਿਹੜੇ ਹੁੰਦੇ ਹੈ ਉਹਨਾਂ ਨੂੰ ਕਾਫ਼ੀ ਲੋੜ ਹੁੰਦੀ ਹੈ ਜਾਣੀ ਕਿ ਭੱਜ ਦੋੜ ਕਾਫ਼ੀ ਕਰਨੀ ਪੈਂਦੀ ਹੈ ਡਾ ਕੋਈ ਸਹੂਲਤ ਨਹੀਂ ਨੇੜੇ ਤੇੜੇ ਕੋਈ ਹੈਗੀ ਇਸ ਕਰਕੇ ਡਾਕਟਰਾਂ ਦੀ ਸਹੂਲਤਾਂ ਬਹੁਤ ਜ਼ਿਆਦਾ ਜਰੂਰੀ ਹਨ